ਬਾਬਾ ਬੁੱਲੇ ਸ਼ਾਹ ਜੀ ਬਾਰੇ ਕੌਣ ਨਹੀਂ ਜਾਣਦਾ ਉਹਨਾਂ ਦੇ ਕਵਿਤਾਵਾਂ ਨੇ ਪੰਜਾਬ ਦੇ ਇਤਿਹਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਉਹਨਾਂ ਦੀਆਂ ਕਵਿਤਾਵਾਂ ਦਾ ਲੋਕਾਂ ਦੇ ਮਨ ਉੱਤੇ ਇਹੋ ਜਿਹਾ ਅਸਰ ਪਿਆ ਵੀ ਲੋਕ ਮਸਤ ਹੋ ਗਏ ਉਹਨਾਂ ਦੀ ਕਵਿਤਾਵਾਂ ਜਿਵੇਂ ਕਿ ਮੇਰਾ ਪੀਆ ਘਰ ਆਇਆ ਆਰਾਮ ਨਾਲ ਕਰ ਦਮਾ ਦਮ ਮਸਤ ਕਲੰਦਰ ਸਾਡੇ ਵਿਹੜੇ ਆਇਆ ਕਰ ਆਦਿ ਕਵਿਤਾਵਾਂ ਬਹੁਤ ਹੀ ਮਨ ਪਸੰਦ ਹਨ ਉਹਨਾਂ ਨੇ ਪੰਜਾਬ ਦੇ ਇਤਿਹਾਸ ਅਤੇ ਪੰਜਾਬੀ ਸਮਾਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਉਹ ਪੰਜਾਬ ਵਿੱਚ ਸਭ ਤੋਂ ਵਧੀਆ ਕਵੀ ਰਹੇ ਹਨ ਅਤੇ ਉਹਨਾਂ ਦਾ ਨਾਮ ਅਜੇ ਤੱਕ ਵੀ ਪੰਜਾਬ ਦੇ ਹਰ ਇੱਕ ਵਿਅਕਤੀ ਦੇ ਮੂੰਹ ਉੱਤੇ ਆ ਹੀ ਜਾਂਦਾ ਹੈ ਬੁੱਲਾਂ ਕੀ ਜਾਣੈ ਮੈਂ ਕੌਣ ਇਸ ਕਵਿਤਾਵਾਂ ਦਾ ਲੋਕਾਂ ਨੇ ਇੱਕ ਸੰਗੀਤ ਵਿੱਚ ਵੀ ਨਿਰਵਾਨ ਕੀਤਾ ਹੋਇਆ ਹੈ ਕੋਈ ਇਸ ਨੂੰ ਕਵਿਤਾਵਾਂ ਦੇ ਰੂਪ 'ਚ ਜਾਣਦਾ ਹੈ ਅਤੇ ਕੋਈ ਇਸ ਨੂੰ ਗਾਣਿਆਂ ਦੇ ਰੂਪ ਵਿੱਚ ਜਾਣਦਾ ਹੈ ਜੀ ਬਾਬਾ ਬੁੱਲੇ ਸ਼ਾਹ ਜੀ ਦੇ ਇਸ ਗਾਣੇ ਬੁੱਲਾ ਕੀ ਜਾਣਾ ਮੈਂ ਕੌਣ ਦਾ ਮੇਰੇ ਮਨ ਉੱਪਰ ਬਹੁਤ ਡੂੰਘਾ ਅਸਰ ਪਿਆ ਹੈ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਪੁਰਾਣੇ ਪੰਜਾਬ ਵਿੱਚ ਵਾਪਿਸ ਜਾਵਾਂ ਅਤੇ ਉਹਨਾਂ ਦੇ ਮੂੰਹੋਂ ਇਹ ਕਵਿਤਾਵਾਂ ਅਤੇ ਸੂਫੀ ਕਵੀਆਂ ਦੇ ਬਾਰੇ ਇਹ ਉਹਨਾਂ ਦੇ ਮੂੰਹ ਤੋਂ ਹੀ ਸੁਣਾ ਅਤੇ ਮੇਰਾ ਬਹੁਤ ਹੀ ਮਨ ਪਸੰਦੀਦਾ ਸੌਂਗ